ਹੈਲੋ ਤੁਸੀਂ ਐਮਾਜੋਨ ਤੋਂ ਬੋਲਦੇ ਜੀ ਹਾਂਜੀ ਮੈਂ ਨਾ ਤੁਹਾਡੇ ਕੋਲੋਂ ਇੱਕ ਏ ਸੀ ਖਰੀਦਿਆ ਸੀ ਅਤੇ ਉਹਦੇ ਸੰਬੰਧ 'ਚ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਬਹੁਤ ਵਧੀਆ ਪ੍ਰੋਡਕਟ ਆ ਮੇਰਾ ਐਕਸਪੀਰੀਐਂਸ ਮੇਰਾ ਰਿਹਾ ਵਾ ਅਸੀਂ ਬਾਜ਼ਾਰ 'ਚੋਂ ਲੱਭਦੇ ਸੀ ਜੋ ਇਹਦੇ ਨਾਲ ਦਾ ਸੇਮ ਏ ਸੀ ਪਰ ਸਾਨੂੰ ਬਹੁਤ ਮਹਿੰਗਾ ਪੈਂਦਾ ਸੀ ਇੱਕ ਤਾਂ ਤੁਹਾਡੀ ਸਾਈਟ ਤੋਂ ਸਾਨੂੰ ਕਾਫੀ ਸਸਤਾ ਲੱਗਾ ਵਾ ਅਤੇ ਦੂਜਾ ਡਿਲੀਵਰੀ ਦਾ ਬਦਾ ਬੜਾ ਵਧੀਆ ਤੁਹਾਡਾ ਪ੍ਰਬੰਧ ਰਿਹਾ ਜਿਹੜਾ ਤੁਸੀਂ ਔਨ ਦੀ ਸਪੋਟ ਇੱਕ ਦਿਨ ਦੇ ਵਿੱਚ ਡਿਲੀਵਰੀ ਕਰਤੀ ਸਾਨੂੰ ਸਾਨੂੰ ਇਹ ਗੱਲ ਦੀ ਵੀ ਬੜੀ ਖੁਸ਼ੀ ਆ ਜਿਹੜਾ ਇਹਦੇ ਬਾਰੇ 'ਚ ਹੋਰ ਤੁਹਾਨੂੰ ਮੈਂ ਦੱਸਾਂ ਵੀ ਇਹਦੀ ਬਿਜਲੀ ਬਹੁਤ ਘੱਟ ਖਿੱਚਦਾ ਲਾਈਟ ਦੀ ਵੀ ਬੱਚਤ ਹੈ ਕਾਫੀ ਸਾਡੀ ਉਹਦੇ ਨਾਲ ਸਾਨੂੰ ਬਿ ਬਿਜਲੀ ਦਾ ਬਿੱਲ ਵੀ ਘੱਟ ਆਊਗਾ ਅਤੇ ਕੂਲਿੰਗ ਵੀ ਬਹੁਤ ਵਧੀਆ ਇਹਦੀ ਕਮਰਾ ਜਲਦੀ ਠੰਢਾ ਕਰ ਦਿੰਦਾ ਵਾ ਅਤੇ ਇਹਦੀ ਨਾ ਤਾਂ ਆਵਾਜ਼ ਆਉਂਦੀ ਆ ਕੋਈ ਫਾਲਤੂ ਡਿਸਟਰਬੰਸ ਵੀ ਕੋਈ ਨਹੀਂ ਹੈਗੀ ਸਾਨੂੰ ਅਤੇ ਬਹੁਤ ਵਧੀਆ ਲੱਗਦਾ ਨਹੀਂ ਤਾਂ ਬਾਜ਼ਾਰ ਦੇ ਵਿੱਚੋਂ ਲੈਂਦੇ ਅਸੀਂ ਤਾਂ ਸਾਨੂੰ ਲੈ ਕੇ ਵੀ ਆਪ ਆਉਣਾ ਸੀ ਅਤੇ ਇੱਥੇ ਡਿਲੀਵਰੀ ਵੀ ਤੁਸੀਂ ਆਪ ਹੀ ਕਰਤੀ ਆ ਮੈਂ ਤਾਂ ਚਾਹਾਂਗਾ ਵੀ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਸਾਰਿਆਂ ਨੂੰ ਦੱਸਾਂਗਾ ਕਿ ਜੋ ਵੀ ਅੱਗੇ ਤੋਂ ਪ੍ਰੋਡਕਟ ਲੈਣਾ ਹੋਵੇ ਉਹ ਤੁਹਾਡੀ ਸਾਈਟ ਤੋਂ ਹੀ ਖਰੀਦਿਆ ਜਾਵੇ ਅਤੇ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲ ਕਰਨ ਦਾ